ਮੇਰੇ ਕੋਲ ਬਕਾਇਦਾ ਫੋਟੋਗ੍ਰਾਫੀ ਦੀ ਰਸਮੀ ਸਿਖਲਾਈ ਹੈ ਔਰ ਵਧੀਆ ਫੋਟੋਗ੍ਰਾਫਰ ਬਣਨ ਲਈ ਅਸੀਂ ਦੂਸਰੇ ਫੋਟੋਗ੍ਰਾਫਰਾਂ ਤੋਂ ਵੀ ਹੁਨਰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੂਸਰਾ ਫੋਟੋਗ੍ਰਾਫਰ ਕਿਵੇਂ ਫੋਟੋ ਖਿੱਚਦਾ ਉਹ ਤੋਂ ਅਸੀਂ ਉਹਦੇ ਐਕਸਪੋਜ਼ਿੰਗ ਤੋਂ ਉਹਦੇ ਹੁਨਰ ਤੋਂ ਅਸੀਂ ਬੜਾ ਕੁਝ ਸਿੱਖਣ ਨੂੰ ਲੈਂਦੇ ਹਾਂ ਅਤੇ ਸਾਡੀ ਜਿਹੜੀ ਪ੍ਰੇਰਨਾ ਸਰ ਸ੍ਰੋਤ ਹੈ ਉਹ ਸਾਡੇ ਦੂਸਰੇ ਫੋਟੋਗ੍ਰਾਫਰ ਹਨ